ਸਾਨੂੰ ਆਪਣੇ ਰਾਜ ਸਮਾਜ ਦੇ ਸੱਭਿਆਚਾਰਕ ਪ੍ਰੰਪਰਾਗਤ ਪਹਿਰਾਵੇ ਕੱਪੜੇ ਗਹਿਣੇ ਬਹੁਤ ਹੀ ਸੋਹਣੇ ਲੱਗਦੇ ਹਨ ਪੰਜਾਬ ਦੇ ਲੋਕਾਂ ਦਾ ਕਲਚਰ ਪੰਜਾਬੀ ਹੈ ਇਸ ਲਈ ਪਹਿਰਾਵਾ ਵੀ ਪੰਜਾਬੀ ਹੈ ਜਿਸ ਵਿੱਚ ਕੁੜੀਆਂ ਦਾ ਪਹਿਰਾਵਾ ਪੰਜਾਬੀ ਸੂਟ ਲਹਿੰਗਾ ਘੱਗਰਾ ਆਦਿ ਸ਼ਿੰਗਾਰ ਵਿੱਚ ਸੱਗੀ ਫੁੱਲ ਕਲਿੱਪ ਡੋਰੀਆਂ ਪਰਾਂਦੇ ਆਦਿ ਚੀਜ਼ਾਂ ਚੀਜ਼ਾਂ ਪਹਿਨੀਆਂ ਜਾਂਦੀਆਂ ਹਨ ਮੁੰਡਿਆਂ ਦੇ ਪਹਿਰਾਵੇ ਵਿੱਚ ਕੁੜਤਾ ਪਜਾਮਾ ਚਾਦਰਾ ਸਿਰ 'ਤੇ ਪੱਗ ਹੁੰਦੀ ਹੈ ਜਿਸ ਨਾਲ ਉਹਨਾਂ ਦੀ ਲੁੱਕ ਬਹੁਤ ਸੋਹਣੀ ਲੱਗਦੀ ਹੈ ਇਹ ਸਾਡੇ ਭਾਈਚਾਰਿਆਂ ਵਿੱਚ ਹੋਰ ਦੇਸ਼ਾਂ ਤੋਂ ਵੱਖਰਾ ਹੈ ਦੇਸ਼ਾਂ ਦੇ ਪਹਿਰਾਵੇ ਨਾਲੋਂ ਸਾਡੇ ਪੰਜਾਬ ਦਾ ਪਹਿਰਾਵਾ ਬਹੁਤ ਹੀ ਸੋਹਣਾ ਹੈ ਸਾਨੂੰ ਸਾਡੇ ਦੇਸ਼ ਪਰ ਬਹੁਤ ਮਾਣ ਹੈ ਕਿ ਅਸੀਂ ਪੰਜਾਬੀ ਹਾਂ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਗੀਤ ਗਾਏ ਜਾਂਦੇ ਹਨ ਜੱਟਾਂ 'ਤੇ ਸਭ ਤੋਂ ਵੱਧ ਗਾਣੇ ਲਿਖੇ ਜਾਂਦੇ ਹਨ ਮਿਊਜ਼ਿਕ ਤੋਂ ਬਿਨਾਂ ਫੰਕਸ਼ਨ ਅਧੂਰਾ ਹੁੰਦਾ ਹੈ ਇਸ ਤੋਂ ਇਲਾਵਾ ਮਨੋਰੰਜਨ ਨਹੀਂ ਹੁੰਦਾ